ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਸਰ ਹਾਂਜੀ ਹਾਂਜੀ ਮੈਂ ਪੇਰੈਂਟਸ ਬੋਲਦਾ ਪਿਆਂ ਅੱਛਾ ਅੱਛਾ ਤੁਸੀਂ ਉਹਦੇ ਇੰਚਾਰਜ ਬੋਲਦੇ ਪਏ ਹੋ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂਜੀ ਉਹ ਕੱਲ੍ਹ ਦੱਸ ਵੀ ਰਿਹਾ ਸੀ ਕਿ ਕੋਈ ਟਰਿੱਪ ਜਾ ਰਹੀ ਹੈ ਤਾਂ ਕਰਕੇ ਉਹ ਜਿੱਦ ਕਰ ਰਿਹਾ ਕਿ ਮੈਂ ਵੀਂ ਜਾਣਾ ਹੈਗਾ ਠੀਕ ਹੈ ਅਤੇ ਹਾਂਜੀ ਹਾਂਜੀ ਭੇਜਣਾ ਤਾਂ ਚਾਹੁੰਦੇ ਹਾਂ ਅਸੀਂ ਅਤੇ ਫ਼ੀਸ ਜਿਹੜੀ ਹੈ ਉਹ ਕਿੰਨੀ ਹੋਏਗੀ ਅੱਛਾ ਅੱਛਾ ਸਰ ਜੇ ਜਿਹੜਾ ਰੋਟੀ ਪਾਣੀ ਦਾ ਖਰਚਾ ਉਹ ਵੱਖਰਾ ਦੇਣਾ ਪਏਗਾ ਜਾਂ ਅਮ ਕਿੱਦਾਂ ਅੱਛਾ ਅੱਛਾ ਅੱਛਾ ਅੱਛਾ

ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ ਚਲੋ ਸਰ ਉਹਦਾ ਨਾ ਨਾਮ ਲਿਖ ਲਿਓ ਅਤੇ ਮੈਂ ਤੁਹਾਨੂੰ ਕੱਲ੍ਹ ਪੈਸੇ ਆ ਕੇ ਦੇ ਦੇਵਾਂਗਾ ਸਵੇਰੇ ਠੀਕ ਥੈਂਕ ਯੂ